ਪੰਜਾਬ ਵਿੱਚ ਵੱਖ ਵੱਖ ਕਿਸਮ ਦੇ ਅਯੋਗ ਹਨ ਜਿਸ ਵਿੱਚ ਆਟੋਮਬੈਲ ਅਤੇ ਇਲੈਕਟਰੋਨਿਕਸ ਅਤੇ ਹੋਰ ਬਹੁਤ ਅਯੋਗ ਹਨ ਇਸ ਵਿੱਚ ਮੁੱਖ ਤੌਰ 'ਤੇ ਸੈਕਲ ਬਣਾਉਣ ਦਾ ਅਯੋਗ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪੰਜਾਬ ਪੂਰੇ ਏਸ਼ੀਆ ਵਿੱਚ ਮਸ਼ਹੂਰ ਹੈ ਇਸ ਤੋਂ ਇਲਾਵਾ ਕੱਪੜਾ ਉਦਯੋਗ ਵਿੱਚ ਵੀ ਪੰਜਾਬ ਮੋਰੀ ਹੈ ਬਾਹਰੋਂ ਵਪਾਰੀ ਪੰਜਾਬ ਵਿੱਚ ਵਪਾਰ ਕਰਨ ਲਈ ਆਉਂਦੇ ਹਨ ਅਤੇ ਪ੍ਰਵਾਸੀ ਮਜ਼ਦੂਰ ਮਜ਼ਦੂਰੀ ਲਈ ਪੰਜਾਬ ਦੀਆਂ ਫੈਕਟਰੀਆਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੈਕਲ ਉਦਯੋਗ ਦੀ ਪੰਜਾਬ ਦੇ ਮਾਲਵੇ ਦੇ ਮੁੱਖ ਸ਼ਹਿਰ ਲੁਧਿਆਣਾ ਨੂੰ ਸੈਕਲ ਉਦਯੋਗ ਦਾ ਮੁੱਖ ਕੇਂਦਰ ਮੰਨਿਆ ਗਿਆ ਹੈ ਇੱਥੋਂ ਦੇ ਬਣੇ ਸੈਕਲ ਪੂਰੇ ਏਸ਼ੀਆ ਵਿੱਚ ਬਿਕਰੀ ਲਈ ਜਾਂਦੇ ਹਨ ਅਤੇ ਲੋਹਾ ਉਦਯੋਗ ਵਿੱਚ ਪੰਜਾਬ ਦਾ ਸ਼ਹਿਰ ਮੰਡੀ ਗੋਬਿੰਦਗੜ੍ਹ ਮਸ਼ਹੂਰ ਹੈ ਇੱਥੇ ਲੋਹੇ ਦੀਆਂ ਹਜ਼ਾਰਾਂ ਮਿੱਲਾਂ ਹਨ ਹੁਨ ਜੇ ਕੱਪੜੇ ਦੇ ਉਦਯੋਗ ਦੀ ਗੱਲ ਕਰੀਏ ਤਾਂ ਪੰਜਾਬ ਦਾ ਲੁਧਿਆਣਾ

ਸਾਰੇ ਦੇਸ਼ ਦੇ ਵਪਾਰੀ ਪੰਜਾਬ ਵਿੱਚ ਕੱਪੜੇ ਦਾ ਵਪਾਰ ਕਰਨ ਲਈ ਪੰਜਾਬ ਆਉਂਦੇ ਹਨ ਇਸ ਤੋਂ ਇਲਾਵਾ ਖੇਡਾਂ ਦਾ ਸਮਾਨ ਲਈ ਜਲੰਧਰ ਪੂਰੇ ਦੁਨੀਆਂ ਵਿੱਚ ਪ੍ਰਸਿੱਧ ਹੈ ਇੱਥੇ ਲਗਭਗ ਸਾਰੀਆਂ ਖੇਡਾਂ ਦਾ ਸਮਾਨ ਬਣਦਾ ਹੈ ਇੱਥੋਂ ਦਾ ਬਣਿਆ ਸਮਾਨ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵੱਲੋਂ ਵਰਤਿਆਂ ਜਾਂਦਾ ਹੈ ਇਹਨਾਂ ਉਦਯੋਗਾਂ ਵਿੱਚ ਪੰਜਾਬ ਮਸ਼ਹੂਰ ਹੈ ਉਦਯੋਗਾਂ ਤੋਂ ਇਲਾਵਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਵੱਧ ਗਿਣਤੀ ਵਿੱਚ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ ਤਾਂ ਕਰਕੇ ਪੰਜਾਬ ਦੇ ਲੋਕਾਂ ਦਾ ਰੁਝਾਨ ਮਜ਼ਦੂਰੀ ਵੱਲ ਘੱਟ ਹੈ ਪੰਜਾਬ ਦੇ ਉਦਯੋਗ ਵਿੱਚ ਮਜ਼ਦੂਰੀ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵੱਧ ਹੈ ਅਤੇ ਪੰਜਾਬ ਦੇ ਉਦਯੋਗਪਤੀਆਂ ਨੂੰ ਮਜ਼ਦੂਰਾਂ ਦੀ ਘਾਟ ਰਹਿੰਦੀ ਹੈ ਪਰ ਫੇਰ ਵੀ ਪੰਜਾਬ ਚ ਨਵੇਂ ਉਦਯੋਗ ਲੱਗ ਰਹੇ ਹਨ ਅਤੇ ਪੰਜਾਬ ਤੋਂ ਬਣਿਆ ਸਮਾਨ ਸਾਰੀ ਦੁਨੀਆਂ ਵਿੱਚ ਬਿਕਰੀ ਲਈ ਜਾਂਦਾ ਰਹੇਗਾ